ਡੇਂਗੂ ਬੁਖਾਰ ਅਤੇ ਮਲੇਰੀਆ ਵਰਗੀਆਂ ਮੱਛਰਾਂ ਤੋਂ ਪੈਦਾ ਹੋਣ ਵਾਲੀ ਬਿਮਾਰੀਆਂ ਤੋਂ ਬਚਣ ਲਈ ਕਈ ਅਭਿਆਸਾਂ ਦੀ ਪਾਲਣਾ ਕੀਤੀ ਜਾ ਸਕਦੀ ਹੈ ਬਰੀਡਿੰਗ ਸਾਈਟਾਂ ਨੂੰ ਖਤਮ ਕਰੋ ਮੱਛਰ ਖੜ੍ਹੇ ਪਾਣੀ ਵਿੱਚ ਪੈਦਾ ਹੁੰਦੇ ਹਨ ਇਸ ਲਈ ਘਰਾਂ ਅਤੇ ਭਾਈਚਾਰਿਆਂ ਦੇ ਆਲੇ ਦੁਆਲੇ ਖੜ੍ਹੇ ਪਾਣੀ ਨੂੰ ਖਤਮ ਕਰਨਾ ਮਹੱਤਵਪੂਰਨ ਹੈ ਇਸ ਵਿੱਚ ਕੰਟੇਨਰਾਂ ਨੂੰ ਖਾਲੀ ਕਰਨਾ ਬੰਦ ਹੋਏ ਗਟਰਾਂ ਨੂੰ ਸਾਫ ਕਰਨਾ ਪਾਣੀ ਦੇ ਭੰਡਾਰਨ ਦੇਖਣ ਨੂੰ ਢਕਣਾ ਅਤੇ ਸਹੀ ਨਿਕਾਸੀ ਨੂੰ ਯਕੀਨੀ ਬਣਾਉਣਾ ਸ਼ਾਮਲ ਹੈ ਮੱਛਰ ਭਜਾਉਣ ਵਾਲੀਆਂ ਦਵਾਈਆਂ ਦੀ ਵਰਤੋਂ ਕਰੋ ਮੱਛਰਾਂ ਨੂੰ ਭਜਾਉਣ ਲਈ ਟੀ ਈ ਟੀ ਪੀਕਾਰਡੀਨ ਜਾਂ ਨਿੰਬੂ ਯੂਕਲਿਪਟਿਸ ਦਾ ਤੇਲ ਬਾਲਕੀਟ ਵਜਾਉਣ ਵਾਲੀ ਚਮੜੀ ਅਤੇ ਕੱਪੜਿਆਂ ਉੱਤੇ ਲਗਾਓ ਮੱਛਰਾਂ ਨੂੰ ਰਹਿਣ ਵਾਲੀਆਂ ਥਾਵਾਂ 'ਤੇ ਦਾਖਲ ਹੋਣ ਤੋਂ ਰੋਕਣ ਲਈ ਖਿੜਕੀਆਂ ਅਤੇ ਦਰਵਾਜ਼ਿਆਂ 'ਤੇ ਮੱਛਰਦਾਨੀਆਂ ਵਰਤੋਂ ਕਰੋ ਸੁਰੱਖਿਆ ਵਾਲੇ ਕੱਪੜੇ ਪਹਿਨੋ ਬਾਹਰ ਹੋਣ ਵੇਲੇ ਲੰਬੀਆਂ ਬਾਹਾਂ ਪੈਂਟਾਂ ਅਤੇ ਜੁਰਾਬਾਂ ਪਹਿਨੋ ਖਾਸ ਤੌਰ ਉੱਤੇ ਮੱਛਰਾਂ ਦੇ ਕੱਟਣ ਦੇ ਸਮੇਂ ਜਿਵੇਂ ਕਿ ਸਵੇਰ ਅਤੇ ਸ਼ਾਮ ਦੇ ਸਮੇਂ ਮੱਛਰ ਦੇ ਕੱਟਣ ਦੇ ਸੰਪਰਕ ਨੂੰ ਘਟਾਉਣ ਲਈ ਮੱਛਰ ਨਿਯੰਤਰਣ ਉਪਾਏ ਸਥਾਪਿਤ ਕਰੋ ਮੱਛਰ ਨਿਯੰਤਰਣ ਉਪਾਅ ਜਿਵੇਂ ਕਿ ਮੱਛਰ ਕੋਇਲ ਇਲੈਕਟਰਿਕ ਮੱਛਰ ਭਜਾਉਣ ਵਾਲੇ ਯੰਤਰ ਜਾਂ ਘਰ ਦੇ ਅੰਦਰ ਮੱਛਰਾਂ ਦੀ ਆਬਾਦੀ ਨੂੰ ਘਟਾਉਣ ਲਈ ਅੰਦਰਲੀ ਰਹਿੰਦ ਖੂੰਹਦ ਦੇ ਛਿੜਕਾਅ ਦੀ ਵਰਤੋਂ ਕਰੋ ਡਾਕਟਰੀ ਦੇਖਭਾਲ ਲਓ ਜੇਕਰ ਤੁਹਾਨੂੰ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਬੁਖਾਰ ਸਿਰ ਦਰਦ ਸਰੀਰ ਵਿੱਚ ਦਰਦ ਅਤੇ ਥਕਾਵਟ ਅਤੇ ਲੱਛਣ ਮਹਿਸੂਸ ਹੁੰਦੇ ਹਨ ਤਾਂ ਡਾਕਟਰੀ ਦੇਖਭਾਲ ਲਉ ਜਟਿਲਤਾਵਾਂ ਰੋਕਣ ਅਤੇ ਬਿਮਾਰੀ ਨੂੰ ਦੂਸਰਿਆਂ ਤੱਕ ਫੈਲਾਉਣ ਲਈ ਜਲਦੀ ਨਿਦਾਨ ਅਤੇ ਇਲਾਜ ਜ਼ਰੂਰੀ ਹੈ ਕਮਿਊਨਿਟੀ ਐਕਸ਼ਨ ਕਮਿਊਨਿਟੀ ਅਧਾਰ ਤੋਂ ਮੱਛਰ ਕੰਟਰੋਲ ਯਤਨਾਂ ਵਿੱਚ ਸ਼ਾਮਲ ਹੋਣਾ ਜਿਵੇਂ ਕਿ ਸਫਾਈ ਮੁਹਿੰਮਾਂ ਦਾ ਆਯੋਜਨ ਕਰਨਾ ਮੱਛਰ ਤੋਂ ਪੈਦਾ ਹੋਣ ਵਾਲੀ ਬਿਮਾਰੀਆਂ ਬਾਰੇ ਜਾਗਰੂਕਤਾ ਨੂੰ ਉਤਸ਼ਾਹਿਤ ਕਰਨਾ ਅਤੇ ਵੈਕਟਰ ਕੰਟਰੋਲ ਉਪਾਵਾਂ ਨੂੰ ਲਾਗੂ ਕਰਨ ਲਈ ਸਥਾਨਕ ਸਿਹਤ ਅਧਿਕਾਰੀਆਂ ਨਾਲ ਸਹਿਯੋਗ ਕਰਨਾ ਯਾਤਰਾ ਸੰਬੰਧੀ ਸਾਵਧਾਨੀਆਂ ਜੇਕਰ ਮੱਛਰ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੇ ਪ੍ਰਚਲਿਤ ਖੇਤਰਾਂ ਦੀ ਯਾਤਰਾ ਕਰ ਰਹੇ ਹੋ ਤਾਂ ਵਾਧੂ ਸਾਵਧਾਨੀ ਵਰਤੋ ਜਿਵੇਂ ਕਿ ਬਿਸਤਰੇ 'ਤੇ ਜਾਲ ਦੀ ਵਰਤੋਂ ਕਰਨਾ ਏਅਰ ਕੰਡੀਸ਼ਨਰ ਜਾਂ ਸਕਰੀਨ ਇਨ ਰਿਹਾਇਸ਼ਾਂ ਵਿੱਚ ਰਹਿਣਾ ਅਤੇ ਤਜਵੀਜ਼ ਅਨੁਸਾਰ ਮਲੇਰੀਏ ਵਿਰੋਧੀ ਦਵਾਈ ਲੈਣਾ ਟੀਕਾਕਰਨ ਪੀਲੇ ਬੁਖਾਰ ਵਰਗੀਆਂ ਬਿਮਾਰੀਆਂ ਲਈ ਟੀਕਾਕਰਨ ਉਪਲਬਧ ਹੋ ਸਕਦਾ ਹੈ ਅਤੇ ਕੁਝ ਖਾਸ ਖੇਤਰਾਂ ਦੇ ਯਾਤਰੀਆਂ ਲਈ ਸਿਫਾਰਸ਼ ਕੀਤੀ ਜਾ ਸਕਦੀ ਹੈ ਜਿੱਥੇ ਬਿਮਾਰੀ ਸਥਾਨਕ ਹੈ ਖਾਸ ਟੀਕਾਕਰਨ ਸਿਫਾਰਸ਼ਾਂ ਲਈ ਸਿਹਤ ਸੰਭਾਲ ਪ੍ਰਦਾਤਾਵਾਂ ਜਾਂ ਯਾਤਰਾ ਕਲੀਨਿਕਾਂ ਨਾਲ ਸੰਪਰਕ ਕਰੋ ਵਾਤਾਵਰਨ ਪ੍ਰਬੰਧਨ ਵਾਤਾਵਰਨ ਪ੍ਰਬੰਧਨ ਰਣਨੀਤੀਆਂ ਨੂੰ ਲਾਗੂ ਕਰੋ ਜਿਵੇਂ ਕਿ ਦਲਦਲ 'ਚੋਂ ਦਲਦਲ ਨੂੰ ਕੱਢਣਾ ਬਨਸਪਤੀ ਨੂੰ ਸਾਫ ਕਰਨਾ ਅਤੇ ਵੱਡੇ ਪੈਮਾਨੇ ਦੀਆਂ ਸੈਟਿੰਗਾਂ ਵਿੱਚ ਮੱਛਰਾਂ ਦੇ ਪ੍ਰਜਣਨ ਦੇ ਨਿਵਾਸ ਸਥਾਨ ਨੂੰ ਘਟਾਉਣ ਲਈ ਜੈਵਿਕ ਨਿਯੰਤਰਣ ਵਿਧੀਆਂ ਦੀ ਵਰਤੋਂ ਕਰਨਾ ਜਨਤਕ ਸਿਹਤ ਅਤੇ ਦਖਲ ਸਰਕਾਰਾਂ ਅਤੇ ਜਨਤਕ ਸਿਹਤ ਅਥਾਰਟੀ ਕਮਿਊਨੀਟੀ ਪੱਧਰ 'ਤੇ ਮੱਛਰ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਅਤੇ ਕੰਟਰੋਲ ਕਰਨ ਲਈ ਮੱਛਰ ਕੰਟਰੋਲ ਪ੍ਰੋਗਰਾਮਾਂ ਨਿਗਰਾਨੀ ਪ੍ਰਣਾਲੀਆਂ ਅਤੇ ਜਨਤਕ ਜਾਗਰੂਕਤਾ ਮੁਹਿੰਮ ਮੁਹਿੰਮਾਂ ਨੂੰ ਲਾਗੂ ਕਰਨ ਵਿੱਚ ਮਹੱਤਵਪੂਰਨ ਨ ਭੂਮਿਕਾ ਨਿਭਾਉਂਦੇ ਹਨ ਇਹਨਾਂ ਰੋਕਥਾਮ ਉਪਾਵਾਂ ਨੂੰ ਅਪਣਾ ਕੇ ਅਤੇ ਕਮਿਊਨਿਟੀ ਅਧਾਰ 'ਤੇ ਯਤਨਾਂ ਨੂੰ ਉਤਸ਼ਾਹਿਤ ਕਰਨ ਨਾਲ ਵਿਅਕਤੀ ਅਤੇ ਭਾਈਚਾਰੇ ਮੱਛਰ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੇ ਜੋਖਮ ਨੂੰ ਘਟਾ ਸਕਦੇ ਹਨ ਅਤੇ ਸਮੁੱਚੀ ਜਨਤਕ ਸਿਹਤ ਅਤੇ ਤੰਦਰੁਸਤੀ ਵਿੱਚ ਯੋਗਦਾਨ ਪਾ ਸਕਦੇ ਹਨ